ਸੋਲਾਂ ਦਸ ਦੋ ਹਜ਼ਾਰ ਚਾਰ ਇੱਕੀ ਬਾਰਾਂ ਦੋ ਹਜ਼ਾਰ ਚਾਰ ਤੇਰਾਂ ਚਾਰ ਸੋਲਾਂ ਸੌ ਨੜ੍ਹਿਨਵੇਂ ਦੋ ਛੇ ਉੱਨੀ ਸੌ ਚੁਰਾਸੀ ਇੱਕ ਇੱਕ ਉੱਨੀ ਸੌ ਚੁਰਾਸੀ